ਹਾਂਜੀ ਜੇਕਰ ਮਛੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਮਛੇਰੇ ਸਾਡੇ ਖੇਤਰ ਵਿੱਚ ਰਹਿੰਦੇ ਹਨ ਅਤੇ ਇਹ ਹੋਰ ਭਾਈਚਾਰੇ ਵਾਂਗ ਹੀ ਮਿਲ ਜੁਲ ਕੇ ਰਹਿੰਦੇ ਹਨ ਅਤੇ ਇਹ ਆਪਣਾ ਦਿਨ ਰਾਤ ਮੱਛੀਆਂ ਫੜਨ ਦਾ ਧੰਦਾ ਕਰਦੇ ਹਨ ਸਾਡੇ ਲਾਗ ਦਰਿਆ ਅਤੇ ਸਮੁੰਦਰਾਂ ਦੇ ਹੋਣ ਕਾਰਨ ਵੀ ਇਹਨਾਂ ਦਾ ਬਹੁਤ ਸਾਰਾ ਬਸੇਰਾ ਹੈ ਅਤੇ ਇਹਨਾਂ ਦੇ ਜਿਹੜੇ ਵੀ ਤਿਉਹਾਰ ਹਨ ਇਹ ਸਾਡੇ ਨਾਲ਼ ਮਿਲ ਜੁਲ ਕੇ ਮਨਾਉਂਦੇ ਹਨ ਅਤੇ ਸਾਡੇ ਤਿਉਹਾਰਾਂ ਵਿੱਚ ਵੀ ਇਹ ਸਾਡੇ ਨਾਲ ਇਕੱਠੇ ਹੁੰਦੇ ਹਨ ਅਤੇ ਤਿਉਹਾਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ਼ ਮਨਾਉਂਦੇ ਹਨ